ਇੰਟਰਨੈਟ ਨੇ ਗੇਮਾਂ ਦੇ ਧਾਰਨਾਂ ਨੂੰ ਬਹੁਤ ਬਦਲ ਦਿੱਤਾ ਹੈ ਹੁਣ ਬੱਚਿਆਂ ਦਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਘਰ ਵਿੱਚ ਹੀ ਬੀਤਦਾ ਹੈ ਕਿਉਂਕਿ ਬੱਚੇ ਗੇਮ ਮੋਬਾਈਲ 'ਤੇ ਅਤੇ ਆਪਣੇ ਲੈਪਟਾਪ 'ਤੇ ਖੇਡਦੇ ਹਨ ਉਹ ਫਿਜੀਕਲ ਐਕਟੀਵਿਟੀਜ਼ ਘੱਟ ਕਰਦੇ ਹਨ ਉਹ ਬਾਹਰ ਖੇਡਣ ਦੀ ਬਜਾਏ ਆਪਣੇ ਘਰ ਵਿੱਚ ਹੀ ਬੈਠ ਕੇ ਜਾਂ ਲੇਟ ਕੇ ਗੇਮਾਂ ਖੇਡਦੇ ਹਨ ਜਿਸ ਕਾਰਨ ਉਹਨਾਂ ਨੂੰ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਅੱਖਾਂ ਦੀ ਰੌਸ਼ਨੀ ਦਾ ਘੱਟ ਹੋਣਾ ਹੋਰ ਵੀ ਕਈ ਤਰ੍ਹਾਂ ਦੀ ਬਿਮਾਰੀਆਂ ਹੈ ਜਿਸ ਕਾਰਨ ਉਹ ਗ੍ਰਸਤ ਹੋ ਰਹੀਆਂ ਹਨ ਇਸ ਕਾਰਨ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਇੱਕ ਸਮਾਂ ਫਿਕਸ ਕੀਤਾ ਜਾਵੇ ਕਿ ਉਹ ਕਿੰਨਾਂ ਟਾਈਮ ਬਾਹਰ ਖੇਡਣ ਅਤੇ ਕਿੰਨਾਂ ਟਾਈਮ ਮੋਬਾਈਲ 'ਤੇ ਪਰ ਹੁਣ ਦੇ ਸਮੇਂ ਵਿੱਚ ਬੱਚੇ ਜ਼ਿਆਦਾ ਤੋਂ ਜ਼ਿਆਦਾ ਮੋਬਾਇਲ ਨੂੰ ਮਹੱਤਵ ਦਿੰਦੇ ਹਨ ਪਰ ਚ ਸਾਨੂੰ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਣ ਕਿਉਂਕਿ ਮੋਬਾਇਲ ਦੇ ਕਾਰਨ ਬੱਚਿਆਂ ਨੂੰ ਕਈ ਬਿਮਾਰੀਆਂ ਦੇ ਸਾਹਮਣਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਉਹਨਾਂ ਨੂੰ ਕਈ ਤਰ੍ਹਾਂ ਦੀ ਬਿਮਾਰੀ ਜਿਵੇਂ ਕਿ ਅੱਖਾਂ ਦੀ ਰੌਸ਼ਨੀ ਘੱਟ ਹੋਣਾ ਨਿਗ੍ਹਾ ਦਾ ਘੱਟ ਹੋਣਾ ਬੈਠੇ ਬੈਠੇ ਦਰਦ ਹੋਣਾ ਪਿੱਠ ਵਿੱਚ ਜਾਂ ਹੋਰ ਵੀ ਕਈ ਤਰ੍ਹਾਂ ਦੀ ਬਿਮਾਰੀਆਂ ਹਨ ਇਸਦੇ ਲਈ ਸਾਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਾਣ ਪੀਣ ਅਤੇ ਉਹਨਾਂ ਦਾ ਇੱਕ ਸਮਾਂ ਫਿਕਸ ਕੀਤਾ ਜਾਵੇ ਤਾਂ ਜੋ ਉਹ ਆਪਣਾ ਜ਼ਿਆਦਾ ਸਮਾਂ ਘਰ ਵਿੱਚ ਬੈਠਣ ਦੀ ਬਜਾਏ ਬਾਹਰ ਖੇਡਣ ਤਾਂ ਕਿ ਉਹਨਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੇ